ਟੈਕਨੋਲਜੀ ਸਾਡੇ ਮਨੋਰੰਜਨ ਦੇ ਤਰੀਕੇ ਨੂੰ ਬਦਲ ਦ ਰਹੀ ਹੈ ਕਿਉਂਕਿ ਅੱਜ ਕੱਲ ਹੁਣ ਤੁਸੀਂ ਦੇਖੋ ਪਹਿਲਾਂ ਤਾਂ ਸਾਡੇ ਕੋਲ ਪੁਰਾਣੇ ਟੀ ਵੀ ਹੁੰਦੇ ਸੀ ਦੂਰਦਰਸ਼ਨ ਚੱਲਦਾ ਸੀ ਸਿਰਫ ਜਿਸ 'ਤੇ ਅਸੀਂ ਸਿਰਫ ਜੋ ਨਾਟਕ ਟਾਈਮ ਸਿਰ ਆਉਂਦੇ ਸੀ ਉਹੀ ਦੇਖ ਸਕਦੇ ਸੀ ਪਰ ਹੁਣ ਅੱਜ ਦਾ ਯੁੱਗ ਬਦਲ ਗਿਆ ਹੈ ਅੱਜ ਦੇ ਯੁੱਗ ਵਿੱਚ ਟੈਕਨੋਲੋਜੀ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਅਸੀਂ ਕੁਛ ਵੀ ਗੇਮਿੰਗ ਮੂਵੀਜ਼ ਯੂਟੀਊਬ 'ਤੇ ਨੈਟਫਲਿਕਸ 'ਤੇ ਕੋਈ ਵੀ ਮੂਵੀ ਜੋ ਹਾਲੇ ਸਿਨੇਮ ਸਿਨੇਮੇ ਵਿੱਚ ਨਹੀਂ ਲੱਗੀਆਂ ਹੁੰਦੀਆਂ ਅਸੀਂ ਉਸ ਨੂੰ ਪਹਿਲਾਂ ਹੀ ਆਪਣੇ ਫੋਨ 'ਤੇ ਡਾਊਨਲੋਡ ਕਰਕੇ ਦੇਖ ਲੈਂਦੇ ਹਾਂ ਘਰ ਬੈਠੇ ਇੰਜੋਏ ਕਰ ਲੈਂਦੇ ਹਾਂ ਕੋਈ ਟੀ ਵੀ ਸ਼ੋਅ ਹੁੰਦਾ ਜੋ ਅਸੀਂ ਨਹੀਂ ਦੇਖ ਪਾਉਂਦੇ ਆਪਣੇ ਕਿਤੇ ਗਏ ਵੇ ਹੁੰਦੇ ਹਾਂ ਜਾਂ ਕਈ ਵਾਰ ਲਾਈਟ ਨਹੀਂ ਹੁੰਦੀ ਸਾਡਾ ਉਹ ਟੀ ਵੀ ਸ਼ੋਅ ਮਿਸ ਹੋ ਜਾਂਦਾ ਪਰ ਅਸੀਂ ਉਸ ਨੂੰ ਦੇਖਣਾ ਚਾਹੁੰਦੇ ਹਾਂ ਟੈਕਨੋਲਜੀ ਦੀ ਤਰੱਕੀ ਦੇ ਬਾਵ ਹੋਣ ਦੇ ਕਾਰਨ ਅਸੀਂ ਉਸ ਸ਼ੋਅ ਨੂੰ ਉਹਨੂੰ ਰਿਪੀਟ ਕਰਕੇ ਵੀ ਦੇਖ ਸਕਦੇ ਹਾਂ ਰਿਕਾਰਡ ਕਰਕੇ ਦੇਖ ਸਕਦੇ ਹਾਂ ਉਸ ਨੂੰ ਨੈੱਟਫਲਿਕਸ 'ਤੇ ਜਾਂ ਸਟਾਰ ਪਲੱਸ 'ਤੇ ਐਦਾਂ ਕਿਸੇ ਵੀ ਚੈਨਲ ਦੇ ਰਾਹੀਂ ਉਸਨੂੰ ਚੈਨਲਾਂ ਦੇ ਰਾਹੀਂ ਦੇਖ ਸਕਦੇ ਹਾਂ ਡਿਸ਼ ਅੱਜ ਕੱਲ ਮੂਵੀਆਂ ਨੂੰ ਦੇਖਣ ਲਈ ਯੂਟੀਊਬਸ ਦਾ ਜ਼ਮਾਨਾ ਆ ਗਿਆ ਯੂਟੀਊਬ 'ਤੇ ਵੀ ਅਸੀਂ ਕੁਛ ਵੀ ਦੇਖ ਸਕਦੇ ਹਾਂ ਅਤੇ ਯੂਟੀਊਬ ਦੇ ਰਾਹੀਂ ਅਸੀਂ ਫੋਨ ਗਾਣੇ ਫਿਲਮਾਂ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਗਿਆਨ ਦੀਆਂ ਚੀਜ਼ਾਂ ਨੂੰ ਸੁਣ ਸਕਦੇ ਹਾਂ ਅਤੇ ਗ ਅਸੀਂ ਦੇਖ ਸਕਦੇ ਹਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਅੱਜ ਦੇ ਯੁੱਗ ਵਿੱਚ ਬਹੁਤ ਜ਼ਿਆਦਾ ਅੱਗੇ ਵੱਧ ਗਈ ਹੈ ਅਤੇ ਟੈਕਨੋਲੋਜੀ ਨਾਲ ਹੀ ਯੁੱਗ ਦੇਸ਼ ਚੱਲ ਰਿਹਾ ਹੈ